ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਛਾਇਆ ਬੁੱਕ ਡਿਪੂ ਤੋਂ ਬੋਲ ਰਹੇ ਹੋ ਹਾਂਜੀ ਮੈਡਮ ਮੈਨੂੰ ਨਾ ਕੁੱਛ ਬੁੱਕਸ ਚਾਹੀਦੀਆਂ ਸੀ ਤਾਂ ਮੈਂ ਹਾਂਜੀ ਮੈਨੂੰ ਦੱਸ ਸਕਦੇ ਓ ਤਾਹਡੇ ਕੋਲੋ ਮਿਲ ਜਾਣਗੀਆਂ ਕੋਮਪੀਟੀਟਿਵ ਲਈ ਚਾਹੀਦੀਆਂ ਸੀ ਮੈਂ ਸੀਨੀਅਰ ਅਸਿਸਟੈਂਟ ਦਾ ਪੇਪਰ ਦੇਣਾ ਹੈ ਉਹਦੇ ਲਈ ਮੈਨੂੰ ਹਾਂਜੀ ਪੋਲੀਟੀ ਹਿਸਟਰੀ ਅਤੇ ਕਰੰਟ ਅਫੇਅਰਸ ਲਈ ਚਾਹੀਦੀਆਂ ਸੀ ਹਾਂਜੀ ਅੱਛਾ ਜੀ ਹਾਂਜੀ

ਠੀਕ ਠੀਕ ਹੈ ਮੈਮ ਅਤੇ ਇਹਨਾਂ ਦੇ ਪ੍ਰਾਈਜ਼ ਬਾਰੇ ਦੱਸ ਸਕਦੇ ਓ ਅੱਛਾ ਜੀ ਠੀਕ ਹੈ ਜੀ ਅੱਛਾ ਠੀਕ ਹੈ ਜੀ ਅੱਛਾ ਜੀ ਚਲੋ ਐਡਰੈਸ ਹਾਂਜੀ ਐਡਰੈਸ ਨੋਟ ਕਰ ਲਓ ਤੁਸੀਂ ਹਾਂਜੀ ਹਾਊਸ ਨੰਬਰ ਵੱਨ ਟੂ ਥਰੀ ਗੁਰੂ ਅੰਗਦ ਨਗਰ ਨਵਾਂਸ਼ਹਿਰ

ਅੱਛਾ ਜੀ ਨਹੀਂ ਨਹੀਂ ਮੈਮ ਮੈਨੂੰ ਤਾਂ ਸਿਰਫ਼ ਪੋਲੀਟੀ ਹਿਸਟਰੀ ਔਰ ਕਰੰਟ ਅਫੇਅਰਸ ਤੁਸੀਂ ਬੁੱਕਸ ਭੇਜਦੋ ਹਾਂਜੀ ਉ ਉਹੀ ਚਾਹੀਦੀਆਂ ਹਾਂਜੀ ਠੀਕ ਹੈ ਮੈਮ ਥੈਂਕਯੂ

ਹਾਂਜੀ ਹਾਂਜੀ ਠੀਕ ਹੈ ਜੀ ਓਕੇ ਮੈਮ ਥੈਂਕਯੂ